ਹੈਲੋ ਹਾਂਜੀ ਨਮਸਕਾਰ ਜੀ ਮੈਂ ਨਰੇਸ਼ ਬੋਲਦਾ ਪਿਆ ਵਧੀਆ ਜੀ ਤੁਸੀਂ ਸੁਣਾਓ ਮੇਰਾ ਜੀ ਬਿਜ਼ਨਸ ਹੈਗਾ ਸੋਫੇ ਦਾ ਮੇਰੀ ਤਾਂ ਕਮਾਈ ਮਤਲਬ ਕਿ ਉਹਦੇ 'ਤੇ ਡਿਪੈਂਡ ਹੈਗਾ ਜਿਸ ਤਰ੍ਹਾਂ ਮਤਲਬ ਕਿ ਸੀਜ਼ਨ ਵਗੈਰਾ 'ਤੇ ਹੀ ਜਿੱਦਾਂ ਹੁਣ ਦਿਵਾਲੀ ਵਗੈਰਾ ਆ ਜਾਵੇ ਕੰਮ ਵੱਧ ਨਿਕਲ ਆਉਂਦਾ ਹਾਂਜੀ ਹਾਂਜੀ ਵਿਆਹ ਸ਼ਾਦੀਆਂ ਚਲੀਆਂ ਵੇ ਇਸ ਵੇਲੇ ਤਾਂ ਮੰਦਾ ਹੀ ਚੱਲੇਗਾ ਅਗਲੇ ਵਿਆਹ ਸ਼ਾਦੀਆਂ ਬੰਦ ਹੈ ਹਾਂਜੀ ਤੁਸੀਂ ਕਾਹਦਾ ਬਿਜ਼ਨਸ ਕਰਦੇ ਅੱਛਾ ਹਾਂਜੀ ਹਾਂਜੀ ਅਤੇ ਅੱਛਾ ਅੱਛਾ ਚਲੋ ਵਧੀਆ ਅ ਰਿਸਪੋਂਸ ਮਿਲਦਾ ਪਿਆ ਮਤਲਬ ਕਿ ਵਧੀਆ ਕੰਮ ਨਿਕਲਦਾ ਪਿਆ ਤੁਹਾਡਾ

ਨਹੀਂ ਉਦਾਂ ਤਾਂ ਕਮਾਈ ਠੀਕ ਹੈ ਸੀਜ਼ਨ ਵਾਈਜ਼ ਚੀਜ਼ਾਂ ਨਿਕਲ ਜਾਂਦੀ ਹੈ ਵਿੱਚ ਵੈਸੇ ਬਾਹਰ ਵੀ ਫੜ੍ਹ ਲਈਦਾ ਆਰਮੀ ਦਾ ਜਾਂ ਕਿੱਦਾਂ ਠੇਕੇ ਠੁਕੇ ਫੜ੍ਹ ਕੇ ਬਾਹਰ ਦਾ ਕੰਮ ਭੁਗਤਾ ਦੀ ਦਾ ਹੈਗਾ ਹਾਂਜੀ ਹਾਂਜੀ ਪ੍ਰਾਈਵੇਟ ਕੰਮ 'ਤੇ ਬਾਹਰ ਦਾ ਵੀ ਨਿਕਲਦਾ ਰਹਿੰਦਾ ਹੈ ਦੁਕਾਨ 'ਤੇ ਜਿਹੜਾ ਘੱਟ ਹੈ ਆਉਂਦੀ ਉਸ ਹਿਸਾਬ ਨਾਲ ਕਰਦੇ ਰਹੀਦਾ ਆ ਹਾਂਜੀ ਠੀਕ ਹੈ ਜੀ ਬਸ ਜੀ ਹਾਂ ਓਕੇ ਜੀ